ਛੋਟੇ ਕਾਰੋਬਾਰ ਆਕਾਰ ਦੇ ਬਾਵਜੂਦ ਵੀ ਸਾਡੇ ਵਾਤਾਵਰਨ ਵਿੱਚ ਪ੍ਰਭਾਵ ਪਾ ਸਕਦੇ ਹਨ ਜਿਵੇਂ ਕਿ ਡਰਾਈਕਲੀਨਰਸ ਸੁੰਦਰਤਾ ਸਲੂਨ ਹਨ ਇਹਨਾਂ ਵਿੱਚ ਰਸਾਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪਾਣੀ ਨੂੰ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਅਤੇ ਇਹਨਾਂ ਦਾ ਕੂੜਾ ਕਾਗਜ਼ ਪਲਾਸਟਿਕ ਜੋ ਵੀ ਹੁੰਦਾ ਹੈ ਉਹਨਾਂ ਨੂੰ ਡੰਪ ਕਰਨ ਲਈ ਕੁਛ ਖਾਸ ਵਿਵਸਥਾ ਵੀ ਨਹੀਂ ਹੁੰਦੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਹੀ ਇਹਨਾਂ ਨੂੰ ਕਦੀ ਪਾਣੀ ਵਿੱਚ ਰੋੜ ਦਿੰਦੇ ਹਨ ਅਤੇ ਕਦੀ ਬਾਹਰ ਇੱਦਾਂ ਹੀ ਸੜਕਾਂ 'ਤੇ ਸੁੱਟ ਦਿੰਦੇ ਹਨ ਇਹਨਾਂ ਕੋਲੋਂ ਨਵੀਨਾਤਮਕ ਤਕਨੀਕਾਂ ਵੀ ਨਹੀਂ ਹੁੰਦੀਆਂ ਜਿਸ ਕਰਕੇ ਜ਼ਿਆਦਾ ਬਿਜਲੀ ਦੀ ਵੀ ਵਰਤੋਂ ਹੁੰਦੀ ਹੈ ਅਤੇ ਕਈ ਵਾਰ ਇੱਦਾਂ ਹੁੰਦਾ ਹੈ ਕਿ ਰਿਹਾਇਸ਼ੀ ਇਲਾਕੇ ਵਿੱਚ ਹੀ ਲੋਕੀ ਛੋਟੀ ਛੋਟੀ ਫੈਕਟਰੀਆਂ ਖੋਲ ਲੈਂਦੇ ਹਨ ਜਾਂ ਫਿਰ ਪ੍ਰਿੰਟਿੰਗ ਪ੍ਰੈਸ ਖੋਲ ਲੈਂਦੇ ਹਨ ਜਿਹਨਾਂ ਦੀ ਮਸ਼ੀਨ ਦੀ ਆਵਾਜ਼ ਸਾਨੂੰ ਬਹੁਤ ਤੰਗ ਕਰਦੀ ਹੈ ਸਾਡੇ ਗੁਆਂਡ 'ਚ ਹੀ ਇੱਦਾਂ ਦੀ ਇੱਕ ਛੋਟੀ ਜਿਹੀ ਦੁਕਾਨ ਹੈ ਅਤੇ ਉੱਥੇ ਸਿਰਫ ਇੱਕ ਮਸ਼ੀਨ ਲੱਗੀ ਹੋਈ ਹੈ ਉਹ ਮਸ਼ੀਨ ਦੀ ਆਵਾਜ਼ ਨਾਲ ਅਸੀਂ ਬਹੁਤ ਪਰੇਸ਼ਾਨ ਹਾਂ ਸਰਕਾਰ ਨੂੰ ਚਾਹੀਦਾ ਹੈ ਕਿ ਨਿਯਮ ਤਾਂ ਬਣੇ ਹੋਏ ਹਨ ਜਿਹੜੇ ਨਿਯਮ ਬਣੇ ਹੋਏ ਹਨ ਉਹਨਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਨਿਯਮਿਤ ਜਾਂਚ ਕਰੇ ਤਾਂ ਜ਼ਰੂਰ ਸੁਧਾਰ ਆ ਸਕਦਾ ਹੈ